ਹਾਂਜੀ ਨਮਸਤੇ ਹੁਣ ਸਾਡਾ ਦੇਸ਼ ਬੋਲਦੇ ਹਾਂ ਪੰਜਾਬੀ ਭਾਸ਼ਾ ਦੇ ਬਾਰੇ ਦੱਸਣਾ ਹੁੰਦਾ ਪੰਜਾਬੀ ਭਾਸ਼ਾ 'ਚ ਜਿੱਦਾਂ ਕਿ ਸਾਡੇ ਪੰਜਾਬ ਵਿੱਚ ਲੋਕਾਂ ਨੂੰ ਪੰਜਾਬੀ ਚੀਜ਼ਾਂ ਬਹੁਤ ਪਸੰਦ ਹਨ ਸਾਗ ਖਾਣਾ ਬਹੁਤ ਪਸੰਦ ਹੈ ਅਤੇ ਸਾਡੇ ਪੰਜਾਬੀਆਂ ਵਿੱਚ ਬਹੁਤ ਫੇਮਸ ਡਿਸ਼ ਹੈ ਔਰ ਸਾਡੇ ਪੰਜਾਬੀ ਜਿੱਦਾਂ ਕਿ ਜਨਾ ਔਰਤਾਂ ਨੂੰ ਸੂਟ ਪਾਉਣਾ ਪਸੰਦ ਹਨ ਅਤੇ ਬੰਦਿਆਂ ਨੂੰ ਪਜਾਮਾ ਕੁੜਤਾ ਪਾਉਣਾ ਬਹੁਤ ਸੋਹਣਾ ਲੱਗਦਾ ਹੈ ਪੰਜਾਬੀ ਭਾਸ਼ਾ ਵਿੱਚ ਔਰ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਸਾਨੂੰ ਜਿੱਦਾਂ ਕਿ ਹਰ ਚੀਜ਼ ਦਾ ਮਨੋਰੰਜਨ ਬਹੁਤ ਸੋਹਣਾ ਲੱਗਦਾ ਹੈ ਕਿ ਪੰਜਾਬ ਵਿੱਚ ਜੋ ਵੀ ਪੰਜਾਬੀ ਵਾਸੀ ਰਹਿੰਦੇ ਹਨ ਅਤੇ ਖੁੱਲ੍ਹੇ ਦਿਲ ਵਾਲੇ ਹੁੰਦੇ ਹਨ ਅਤੇ ਹਰ ਇੱਕ ਇਨਸਾਨ ਨੂੰ ਪਿਆਰ ਨਾਲ ਮਿਲਦੇ ਹਨ ਜਿੱਦਾਂ ਕਿ ਅਸੀਂ ਪੰਜਾਬ ਵਿੱਚ ਹਰ ਚੀਜ਼ ਦਾ ਪੂਰੀ ਤਰ੍ਹਾਂ ਮਨੋਰੰਜਨ ਕਰਦੇ ਹਾਂ ਧੰਨਵਾਦ